ਭੰਗੜਾ ਐਰੋਬਿਕਸ ਇੱਕ ਨਵੀਂ ਕਿਸਮ ਦੀ ਕਸਰਤ ਹੈ ਜੋ ਕਿ ਪੰਜਾਬ ਦੀ ਪ੍ਰਸਿੱਧ ਲੋਕ ਨਾਚ ਭੰਗੜਾ ਤੋਂ ਪ੍ਰੇਰਿਤ ਹੈ ਇਹ ਨਾ ਸਿਰਫ਼ ਇੱਕ ਮਜ਼ੇਦਾਰ ਕਸਰਤ ਹੈ ਸਗੋਂ ਇਹ ਪੰਜਾਬ ਦੇ ਸੱਭਿਆਚਾਰ ਵਿਰਸੇ ਨੂੰ ਵੀ ਦਰਸਾਉਂਦਾ ਹੈ ਮੇਰੇ ਅਨੁਸਾਰ ਭੰਗੜਾ ਐਰੋਬਿਕਸ ਪੰਜਾਬ ਦੇ ਸੱਭਿਆਚਾਰਕ ਵਿਰਸੇ ਨੂੰ ਨਾਲ ਦਰਸਾਉਂਦਾ ਹੈ ਭੰਗੜੇ ਦੀ ਮੂਲ ਭਾਵਨਾ ਭੰਗੜਾ ਐਰੋਬਿਕਸ ਭੰਗੜੇ ਦੀ ਮੂਲ ਭਾਵਨਾ ਨੂੰ ਕਾਇਮ ਰੱਖਦਾ ਹੈ ਜੋ ਕਿ ਖੁਸ਼ੀ ਉਤਸ਼ਾਹ ਅਤੇ ਜੀਵਨ ਦਾ ਜਸ਼ਨ ਹੈ ਇਸ ਨਾਚ ਲੋਕਾਂ ਨੂੰ ਇੱਕਜੁੱਟ ਹੋਣ ਅਤੇ ਆਪਣੀ ਸੱਭਿਆਚਾਰਕ ਰੋਸ਼ਾਨ ਤਾਂ ਜਸ਼ਨ ਮਨਾਉਣ ਲਈ ਪ੍ਰੇਰਿਤ ਕਰਦਾ ਹੈ ਪੰਜਾਬੀ ਸੰਗੀਤ ਅਤੇ ਬੋਲ ਭੰਗੜਾ ਐਰੋਬਿਕਸ ਵਿੱਚ ਅਕਸਰ ਢੋਲ ਤੂੰਬੀ ਅਤੇ ਚਿਮਟੇ ਵਰਗੇ ਪੰਜਾਬੀ ਸਾਜਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਸ ਵਿੱਚ ਪੰਜਾਬੀ ਲੋਕ ਗੀਤਾਂ ਅਤੇ ਬੋਲੀਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਜੋ ਕਿ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ ਹਨ ਪੰਜਾਬੀ ਲਿਬਾਸ ਭੰਗੜਾ ਐਰੋਬਿਕਸ ਵਿੱਚ ਲੋਕ ਆਹ ਰੰਗੀਨ ਪੰਜਾਬੀ ਲਿਬਾਸ ਪਹਿਨਦੇ ਹਨ ਜੋ ਕਿ ਪੰਜਾਬੀ ਸੱਭਿਆਚਾਰ ਦੀ ਇੱਕ ਵਿਲੱਖਣ ਪਛਾਣ ਹੈ ਸਰੀਰਕ ਅਤੇ ਮਾਨਸਿਕ ਸਿਹਤ ਭੰਗੜਾ ਆਰਬਿਕਸ ਨਾਲ ਸਿਰਫ਼ ਸਰੀਰਕ ਸਿਹਤ ਲਈ ਵਧੀਆ ਹੈ ਸਗੋਂ ਇਹ ਮਾਨਸਿਕ ਸਿਹਤ ਲਈ ਵੀ ਫਾਇਦੇਮੰਦ ਹੈ ਇਹ ਤਨਾਅ ਨੂੰ ਘੱਟ ਕਰਦਾ ਅਤੇ ਖੁਸ਼ੀ ਨਾਲ ਉਤਸ਼ਾਹ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ